ਪੰਜਾਬ ਦੀਆਂ ਮੁੱਖ ਭੌਤਿਕ ਵਿਸ਼ੇਸ਼ਤਾਵਾਂ ਇਹ ਹਨ ਕਿ ਜਿਵੇਂ ਤੁਸੀਂ ਦੇਖ ਸਕਦੇ ਹੋ ਹਿਮਾਚਲ ਵਾਲੀ ਸਾਈਡ ਪਹਾੜ ਇਸ ਸਾਈਨ ਟਾਈਮ 'ਤੇ ਬਹੁਤ ਵਧੀਆ ਹਨ ਅਤੇ ਜਿਹੜੀ ਨਦੀਆਂ ਹਨ ਜਿਵੇਂ ਹੋ ਗਿਆ ਗੰਗਾ ਰਿਵਰ ਅਤੇ ਤੁਸੀਂ ਵੇਖ ਸਕਦੇ ਹੋ ਅੱਜ ਕੱਲ੍ਹ ਉਹ ਬਣੀ ਹੀ ਸਵੱਛ ਹੈ ਅਤੇ ਜੋ ਮੈਦਾਨ ਹੈ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਮਿੰਨੀ ਗੋਆ ਹੈ ਮੈਦਾਨ ਉਹ ਵੀ ਬੜਾ ਸਾਫ਼ ਹੈ ਅਤੇ ਉਹ ਵੀ ਤੁਸੀਂ ਵੇਖ ਸਕਦੇ ਹੋ ਉਸ ਦੇ ਕਿਨਾਰੇ ਇੱਕ ਤੱਟ ਵੀ ਹੈ ਜਿੱਥੇ ਕਿ ਇੱਕ ਨਦੀ ਹੈ ਮਤਲਬ ਤਲਾਬ ਟਾਈਪ ਹੈ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਉੱਥੇ ਬਹੁਤ ਹੀ ਹਰਿਆਲੀ ਹੈ ਅਤੇ ਪੰਜਾਬ ਬਹੁਤ ਹੀ ਵਧੀਆ ਤਰੀਕੇ ਨਾਲ ਬਣਾਇਆ ਗਿਆ ਹੈ ਅਤੇ ਤੁਸੀਂ ਵੇਖ ਸਕਦੇ ਹੋ ਕਿ ਅੱਜ ਕੱਲ੍ਹ ਜਿਹੜੇ ਪਹਾੜ ਹੈ ਜਿਵੇਂ ਕਿ ਮਨਾਲੀ ਵਾਲੀ ਸਾਈਡ ਹੋ ਗਿਆ ਬਰਫ਼ ਵਾਲੇ ਪਹਾੜ ਉਹ ਵੀ ਬਹੁਤ ਵਧੀਆ ਹਨ